ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹੋਰ ਕੀ ਹਾਲ ਜੀ ਬਸ ਵਧੀਆ ਜੀ ਵਧੀਆ ਮੈਮ ਅੱਜ ਮੈਂ ਨਿਊਜ਼ ਪੇਪਰ ਪੜ੍ਹ ਰਹੀ ਸੀ ਤੁਸੀਂ ਦੇਖ ਦੇਖਿਆ ਨਿਊਜ਼ ਪੇਪਰ ਅੱਜ ਦਾ ਹਾਂਜੀ ਮੈਂ ਦੇਖ ਰਹੀ ਸੀ ਅੱਗੇ ਆਪਣੇ ਪੰਜਾਬ ਦੇ ਬਹੁਤ ਨਾਮੀ ਜਿਹੜੇ ਗਾਇਕ ਨੇ ਬੜੀਆਂ ਨਾਮੀ ਹਸਤੀਆਂ ਜਿਹੜੀਆਂ ਹੁਣ ਤਾਂ ਉਹ ਬੋਲੀਵੁੱਡ ਵਿੱਚ ਐਂਟਰ ਕਰ ਗਈਆਂ ਹੋਈਆਂ ਨੇ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਹੁਤ ਆਪਣੇ ਪੰਜਾਬ ਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂ ਕਪਿਲ ਸ਼ਰਮਾ ਦਾ ਸ਼ੋ ਲੈ ਲਓ ਇਹ ਵੀ ਤਾਂ ਅੰਮ੍ਰਿਤਸਰ ਦਾ ਹੀ ਹੈ ਹਾਂ ਉਹਦੇ ਸ਼ੋ ਲੈ ਲਓ ਉਹ ਵੀ ਤਾਂ ਹਾਂ ਉਹ ਮਤਲਬ ਕਿ ਆਪਣੇ ਜਿਹੜੇ ਪੰਜਾਬੀ ਨੇ ਹੁਣ ਤਾਂ ਬਹੁਤ ਜ਼ਿਆਦਾ ਬਾਲੀਵੁੱਡ ਦੇ ਵਿੱਚ ਆਪਣਾ ਜਿਹੜਾ ਨਾ ਇਹ ਹਾਂ ਕਾਫੀ ਜਾ ਰਹੇ ਨੇ ਬੜਾ ਨਾਮ ਹੋ ਗਿਆ ਹੁਣ ਤਾਂ ਹਾਂਜੀ ਹਾਂਜੀ ਉਹੀ ਤਾਂ ਮੈਂ ਤੁਹਾਨੂੰ ਕਿਹਾ ਨਾ ਇਹਦਾ ਤਾਂ ਵਰਲਡ ਵਾਈਡਲ ਹੀ ਦੇਖੋ ਨਾ ਬੜਾ ਫੇਮਸ ਰਿਹਾ ਹੈ ਬਿਲਕੁਲ ਬਿਲਕੁਲ ਆਪਣਾ ਪੰਜਾਬ ਦਾ ਚਲੋ ਵਧੀਆ ਗੱਲ ਹੈ ਆਪਣੇ ਪੰਜਾਬ ਦਾ ਨਾਮ ਰੋਸ਼ਨ ਹੋ ਰਿਹਾ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਤਾਂ ਹੈ ਇਹ ਤਾਂ ਪੰਜਾਬ ਲਈ ਬੜੀ ਮਾਣ ਵਾਲੀ ਗੱਲ ਹੈ ਅਤੇ ਵਧੀਆ ਲੱਗਦਾ ਸਾਰਾ ਸੁਣ ਕੇ ਵੀ ਹਾਂ ਆਪਣੇ ਹੋਰ ਸਭ ਮੈਡਮ ਔਰ ਸਭ ਠੀਕ ਠਾਕ ਮੈਮ ਚਲੋ ਸਭ ਵਧੀਆ ਵਧੀਆ ਠੀਕ ਹੈ ਮੈਮ ਸਤਿ ਸ਼੍ਰੀ ਅਕਾਲ ਜੀ